ਟਿਕਾਊ ਅਤੇ ਨੈਤਿਕ ਪਸ਼ੂ ਪਾਲਣ ਦੇ ਅਭਿਆਸਾਂ ਦਾ ਸਮਰਥਨ ਕਰਨ ਦੇ ਲਈ ਸਭ ਤੋਂ ਪਹਿਲਾਂ ਜ਼ਰੂਰੀ ਹੈ ਕਿ ਸਾਡੇ ਕੋਲ ਉਸ ਕਿਸਮ ਦੇ ਜਾਂ ਉਹੀ ਜਾਨਵਰ ਹੋਣ ਜਿਹਨਾਂ ਦਾ ਪਾਲਣ ਪੋਸ਼ਣ ਅਸੀਂ ਸਹੀ ਤਰੀਕੇ ਨਾਲ ਕਰ ਸਕਦੇ ਹਾਂ ਅਤੇ ਜਿਹਨਾਂ ਦੇ ਬਾਰੇ ਸਾਨੂੰ ਪੂਰੀ ਜਾਣਕਾਰੀ ਹੋਵੇ ਪੂਰੀ ਜਾਣਕਾਰੀ ਮਤਲਬ ਉਹਨਾਂ ਦੇ ਹਰੇ ਚਾਰੇ ਦੀ ਉਹਨਾਂ ਦੇ ਦਵਾਈਆਂ ਦੀ ਉਹਨਾਂ ਦੀਆਂ ਬਿਮਾਰੀਆਂ ਬਾਰੇ ਸਾਨੂੰ ਪੂਰੀ ਤਰ੍ਹਾਂ ਜਾਣਕਾਰੀ ਹੋਵੇ ਅਸੀਂ ਕੋਈ ਅਜਿਹਾ ਪਸ਼ੂ ਜਾਂ ਜਾਨਵਰ ਪਾਲ ਲਿਆ ਜਿਸ ਦੇ ਬਾਰੇ ਸਾਨੂੰ ਕੋਈ ਜਾਣਕਾਰੀ ਹੀ ਨਹੀਂ ਠੀਕ ਹੈ ਜੀ ਉਸ ਨੂੰ ਕਿੱਦਾਂ ਦੀਆਂ ਬਿਮਾਰੀਆਂ ਹੋ ਸਕਦੀਆਂ ਨੇ ਜਾਂ ਫੇਰ ਉਹਦਾ ਖਾਣਾ ਦਾਣਾ ਕਿੱਦਾਂ ਦਾ ਹੋ ਸਕਦਾ ਜਾਂ ਉਹਨੂੰ ਸਮੇਂ ਸਮੇਂ 'ਤੇ ਉਹਦਾ ਜੋ ਸਿਹਤ ਦਾ ਚੈੱਕ ਅਪ ਆ ਉਹ ਕਿਵੇਂ ਕਰਵਾਉਣਾ ਤਾਂ ਉਹ ਉਸਦੇ ਵਿੱਚ ਘਾਟਾ ਖਾਣ ਵਾਲੀ ਗੱਲ ਹੈ ਕੋਈ ਉਹ ਟਿਕਾਊ ਅਤੇ ਨੈਤਿਕ ਪਸ਼ੂ ਪਾਲਣ ਦਾ ਅਭਿਆਸ ਨਹੀਂ ਹੋਵੇਗਾ ਹੋਰ ਜਿੱਦਾਂ ਕਿ ਸਰਕਾਰੀ ਸਕੀਮਾਂ ਤੋਂ ਲਾਭ ਮਿਲ ਰਿਹਾ ਹਰੇਕ ਪਿੰਡ ਦੇ ਵਿੱਚ ਬਲਾਕ ਪੱਧਰ 'ਤੇ ਜਾਂ ਫੇਰ ਆਪਾਂ ਜ਼ਿਲ੍ਹਾ ਪੱਧਰ ਦੀ ਗੱਲ ਕਰ ਲਈਏ ਸਰਕਾਰੀ ਹਸਪਤਾਲ ਜੋ ਪਸ਼ੂਆਂ ਵਾਲੇ ਹਸਪਤਾਲ ਬਣੇ ਹੋਏ ਨੇ ਉਹ ਡਾਕਟਰ ਸਮੇਂ ਸਮੇਂ 'ਤੇ ਪਿੰਡਾਂ ਦੇ ਵਿੱਚ ਆਉਂਦੇ ਰਹਿੰਦੇ ਨੇ ਜੋ ਸਰਕਾਰ ਦੀਆਂ ਸਕੀਮਾਂ ਪਸ਼ੂ ਪਾਲਣ ਨੂੰ ਲੈ ਕੇ ਚੱਲ ਰਹੀਆਂ ਨੇ ਉਹਨਾਂ ਬਾਰੇ ਦੱਸਦੇ ਰਹਿੰਦੇ ਨੇ ਜਿਵੇਂ ਕਿ ਬੀਮੇ ਵਗੈਰਾ ਅੱਜ ਕੱਲ੍ਹ ਚੱਲ ਰਹੇ ਨੇ ਪਸ਼ੂਆਂ ਦੇ ਉੱਪਰ ਸੋ ਅਜਿਹੀਆਂ ਮ ਮੰਗਾਂ ਤਾਂ ਮੰਗਾਂ ਅਤੇ ਸਿਫਾਰਿਸ਼ਾਂ ਕੀ ਨੇ ਇਹੀ ਨੇ ਕਿ ਵੀ ਅਗਰ ਤੁਸੀਂ ਪਸ਼ੂ ਪਾਲਣ ਕਰ ਰਹੇ ਓਂ ਟਿਕਾਊ ਅਤੇ ਨੈਤਿਕ ਪਸ਼ੂ ਪਾਲਣ ਚਾਹੁੰਦੇ ਓਂ ਤਾਂ ਸਭ ਤੋਂ ਪਹਿਲਾਂ ਤੁਸੀਂ ਉਸ ਪਸ਼ੂ ਬਾਰੇ ਜੋ ਪਾਲ ਰਹੇ ਓਂ ਉਹਦੇ ਬਾਰੇ ਪੂਰੀ ਜਾਣਕਾਰੀ ਇਕੱਠੀ ਕਰੋ ਫੇਰ ਹੀ ਪਸ਼ੂ ਪਾਲਣ ਆਰੰਭ ਕਰੋ